ਕੀ ਮੈਂ ਆਪਣੇ ਆਲੇ ਦੁਆਲੇ ਵਿੱਚ ਸੁੰਦਰ ਸਥਾਨਾਂ ਜਾਂ ਕੁਦਰਤੀ ਆਕਰਸ਼ਣਾਂ ਦੀ ਸਿਫਾਰਿਸ਼ ਕਰ ਸਕਦੀ ਹਾਂ ਮੈਂ ਬਠਿੰਡਾ ਪਟਿਆਲਾ ਚੰਡੀਗੜ੍ਹ ਅੰਮ੍ਰਿਤਸਰ ਆਹ ਜਗ੍ਹਾ 'ਤੇ ਘੁੰਮੀ ਹੋਈ ਹਾਂ ਜੇ ਮੈਂ ਗੱਲ ਕਰਾਂ ਬਠਿੰਡੇ ਦੀ ਤਾਂ ਬਠਿੰਡਾ ਵਿੱਚ ਕਿਲ੍ਹਾ ਮੁਬਾਰਕ ਜਿਸ ਦੇ ਵਿੱਚ ਕਿ ਗੁਰਦੁਆਰਾ ਸਾਹਿਬ ਹੈ ਇਸ ਨੂੰ ਬਠਿੰਡੇ ਵਿੱਚ ਸਭ ਤੋਂ ਉੱਚੀ ਇਮਾਰਤ ਮੰਨਿਆ ਜਾਂਦਾ ਹੈ ਅਤੇ ਇੱਥੇ ਰਜ਼ੀਆ ਸੁਲਤਾਨ ਨੂੰ ਆ ਜਿਹੜਾ ਕੈਦ ਕਰਕੇ ਰੱਖਿਆ ਗਿਆ ਸੀ ਇੱਕ ਇਹ ਇਤਿਹਾਸਿਕਯੋਗ ਸਥਾਨ ਹੈ ਜੇ ਮੈਂ ਗੱਲ ਕਰਾਂ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਜਿਸ ਨੂੰ ਕਿ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ ਉੱਥੇ ਵੀ ਬਹੁਤ ਦੂਰ ਦੂਰ ਤੋਂ ਲੋਕ ਜੋ ਗੁਰਦੁਆਰਾ ਸਾਹਿਬ ਆਉਂਦੇ ਹਨ ਬਠਿੰਡਾ ਵਿੱਚ ਛੱਤਬੀੜ ਜ਼ੂ ਵੀ ਹੈ ਜਿੱਥੇ ਕਿ ਸਾਨੂੰ ਬਹੁਤ ਸਾਰੇ ਜੋ ਜਾਨਵਰ ਆ ਉਹ ਦੇਖਣ ਨੂੰ ਮਿਲਦੇ ਹਨ ਜੇ ਮੈਂ ਗੱਲ ਕਰਾਂ ਚੰਡੀਗੜ੍ਹ ਦੀ ਚੰਡੀਗੜ੍ਹ ਵਿੱਚ ਘੁੰਮਣ ਲਈ ਜਿੱਦਾਂ ਰੋਜ਼ ਗਾਰਡਨ ਰੋਜ਼ ਗਾਰਡਨ ਛੱਤਬੀੜ ਜੂ ਰੋਕ ਗਾਰਡਨ ਆਦਿ ਮਿਲਦੇ ਹਨ ਅਤੇ ਮੈਂ ਅੰਮ੍ਰਿਤਸਰ ਵੀ ਗਈ ਹੋਈ ਹਾਂ ਅੰਮ੍ਰਿਤਸਰ ਵਿੱਚ ਜਿੱਦਾਂ ਹਰਿਮੰਦਰ ਸਾਹਿਬ ਵਿੱਚ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਵੀ ਆਉਂਦੇ ਹਨ ਉੱਥੇ ਇੱਕ ਦੁਰਗਾ ਦੇਵੀ ਮੰਦਿਰ ਵੀ ਹੈ ਉਸਦੇ ਨਾਲ ਨਾਲ ਵਾਹਗਾ ਬੋਰਡਰ ਅਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕਯੋਗ ਸਥਾਨਾਂ ਹੈ ਜਿਨ੍ਹਾਂ ਨੂੰ ਲੋਕ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਹਨ ਜੇ ਮੈਂ ਗੱਲ ਕਰਾਂ ਪਟਿਆਲਾ ਦੀ ਤਾਂ ਪਟਿਆਲਾ ਵਿੱਚ ਦੁੱਖ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਅਤੇ ਚੰਡੀਗੜ੍ਹ ਵਿੱਚ ਮਹਿੰਦਰ ਚੌਧਰੀ ਮਹਿੰਦਰ ਚੌਧਰੀ ਜ਼ੂਲੋਜੀਕਲ ਗਾਰਡਨ ਜੋ ਹੈ ਦੇਖਣ ਯੋਗ ਹੈ